ਮੌਜੂਦਾ ਹਾਲਾਤਾਂ ਵਿੱਚ ਰਾਜਨੀਤੀ ਬਿਜਨਸ ਬਣ ਚੁੱਕੀ ਹੈ ਸੱਤਾ ਪਾਉਣ ਲਈ ਕਈ ਪਾਰਟੀਆਂ ਧਰਮ ਦਾ ਨਾਂ ਵਰਤਦੀਆਂ ਹਨ ਅਤੇ ਕਈ ਪਾਰਟੀਆਂ ਜਾਤੀਵਾਦ ਦਾ ਨਾਂ ਵਰਤ ਕੇ ਸੱਤਾ ਪਾਉਂਦੀਆਂ ਹਨ ਲੀਡਰ ਜਨਤਾ ਦਾ ਭਲਾ ਬੁਰਾ ਨਾ ਦੇਖਦੇ ਹੋਏ ਸਾਰੇ ਕੰਮ ਆਪਣੇ ਫਾਈਦੇ ਲਈ ਹੀ ਕਰਦੇ ਹਨ ਲੀਡਰ ਆਪਣਾ ਫਾਇਦਾ ਦੇਖਦੇ ਹੋਏ ਪਾਰਟੀਆਂ ਬਦਲ ਲੈਂਦੇ ਹਨ ਸ ਅਤੇ ਸੱਤਾ ਵਿੱਚ ਆਈ ਪਾਰਟੀਆਂ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਦੂਜੀ ਪਾਰਟੀ ਦੇ ਲੀਡਰਾਂ ਨੂੰ ਆਪਣੇ ਪਾਲੇ ਵਿੱਚ ਕਰ ਲੈਂਦੀਆਂ ਹਨ ਸੱਤਾ ਵਿੱਚ ਆਈ ਪਾਰਟੀਆਂ ਲੋਕਾਂ ਦੇ ਭਲੇ ਕਰਨ ਦੀ ਥਾਂ 'ਤੇ ਸੱਤਾ ਅਤੇ ਸਰਕਾਰੀ ਏਜੰਸੀਆਂ ਆਪਣੇ ਫਾਇਦੇ ਲਈ ਹੀ ਵਰਤਦੀਆਂ ਹਨ ਜਨਤਾ ਬਾਰੇ ਕੋਈ ਨਹੀਂ ਸੋਚਦਾ ਪਾਰਟੀਆਂ ਕੁਝ ਵੀ ਕਰਕੇ ਸੱਤਾ ਹਾਸਲ ਕਰਨਾ ਚਾਹੁੰਦੀਆਂ ਹਨ ਸਰਕਾਰਾਂ ਲੋਕਾਂ ਨੂੰ ਧਰਮਾਂ ਦੇ ਨਾਮ 'ਤੇ ਜਾਤੀਆਂ ਦੇ ਨਾਮ 'ਤੇ ਪਾਗਲ ਬਣਾ ਰਹੀਆਂ ਹਨ ਸਰਕਾਰਾਂ ਲੋਕਾਂ ਨੂੰ ਧਰਮਾਂ ਦੇ ਨਾਮ 'ਤੇ ਆਪਸ ਵਿੱਚ ਲੜਵਾ ਕੇ ਸੱਤਾ ਪ੍ਰਾਪਤ ਕਰ ਰਹੀਆਂ ਹਨ ਸਰਕਾਰਾਂ ਵੱਲੋਂ ਲੋਕਾਂ ਨੂੰ ਸ਼ਰੇਆਮ ਪਾਗਲ ਬਣਾਇਆ ਜਾ ਰਿਹਾ ਹੈ ਆਮ ਤੌਰ 'ਤੇ ਸਰਕਾਰਾਂ ਦਾ ਇੱਕੋ ਇੱਕ ਉਪਦੇਸ਼ ਹੈ ਸੱਤਾ ਪਾਉਣਾ ਰਾਜਨੀਤੀ ਨੂੰ ਵਪਾਰ ਵਿੱਚ ਬਦਲਿਆ ਜਾ ਚੁੱਕਾ ਹੈ ਭਾਰਤ ਦਾ ਲੋਕਤੰਤਰ ਸਭ ਤੋਂ ਵੱਡਾ ਲੋਕਤੰਤਰ ਹੈ ਇੱਥੇ ਇੱਕ ਸੌ ਚਾਲ੍ਹੀ ਕਰੋੜ ਭਾਰਤੀ ਆਪਣਾ ਲੀਡਰ ਆਪ ਚੁਣਦੇ ਹਨ ਮੌਜੂਦਾ ਸਮੇਂ ਵਿੱਚ ਲੋਕਤੰਤਰ ਵਿੱਚ ਰਿਸ਼ਵਤ ਖੋਰੀ ਬਹੁਤ ਵੱਧ ਗਈ ਹੈ ਪਾਰਟੀ ਸੱਤਾ ਹਾਸਲ ਕਰਨ ਲਈ ਲੋਕਾਂ ਨੂੰ ਮੁਫਤ ਬਿਜਲੀ ਮੁਫਤ ਕਣਕ ਮੁਫਤ ਚਾਵਲ ਮੁਫਤ ਆਟਾ ਮੁਫਤ ਬੱਸਾਂ ਮੁਫਤ ਰਾਸ਼ਨ ਦੇ ਲਾਲਚ ਦੇ ਕੇ ਵੋਟਾਂ ਹਾਸਿਲ ਕਰ ਰਹੀਆਂ ਹਨ ਲੋਕਾਂ ਨੂੰ ਲੋਕਤੰਤਰ ਵਿੱਚ ਭਿਖਾਰੀ ਬਣਾਇਆ ਜਾ ਚੁੱਕਾ ਹੈ ਲੋਕਾਂ ਨੂੰ ਧਰਮਾਂ ਦੇ ਨਾਮ 'ਤੇ ਪਾਗਲ ਬਣਾ ਕੇ ਵੋਟਾਂ ਹਾਸਲ ਕਰੀਆਂ ਜਾ ਰਹੀਆਂ ਹਨ ਲੀਡਰਾਂ ਦਾ ਸੱਤਾ ਪ੍ਰਾਪਤ ਕਰਨਾ ਹੀ ਇੱਕੋ ਇੱਕ ਮਕਸਦ ਹੈ ਲੋਕਾਂ ਦੀ ਸੇਵਾ ਕੋਈ ਨਹੀਂ ਕਰਦਾ ਸਭ ਸੱਤਾ ਦੇ ਭੁੱਖੇ ਹਨ ਲੀਡਰਾਂ ਪ੍ਰਤੀ ਜੋ ਮੇਰੀ ਸਮਝ ਹੈ ਲੀਡਰਾਂ ਦਾ ਸੱਤਾ ਪ੍ਰਾਪਤ ਕਰਨਾ ਹੀ ਇੱਕਲੋਤਾ ਉਪਦੇਸ਼ ਹੈ ਲੀਡਰ ਸੱਤਾ ਪ੍ਰਾਪਤ ਕਰਨ ਲਈ ਕੁਝ ਵੀ ਕਰ ਸਕਦੇ ਹਨ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਜਨਤਾ ਦੀ ਸੇਵਾ ਕੋਈ ਨਹੀਂ ਕਰਨਾ ਚਾਹੁੰਦਾ ਸਾਰੇ ਲੀਡਰ ਸੱਤਾ ਹੀ ਭਾਲਦੇ ਹਨ ਧਰਮ ਦੇ ਨਾਮ 'ਤੇ ਲੋਕਾਂ ਨੂੰ ਲੜਵਾਇਆ ਜਾ ਰਿਹਾ ਹੈ ਜੇ ਮੈਨੂੰ ਕਿਸੇ ਵੀ ਲੀਡਰ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਮੈਂ ਨੌਜਵਾਨਾਂ ਲਈ ਰੁਜ਼ਗਾਰ ਦਾ ਸਾਧਨ ਬਾਰੇ ਪੁੱਛਣਾ ਚਾਹਵਾਂਗਾ